ਸਤਿ ਸ਼੍ਰੀ ਅਕਾਲ ਮੇਰਾ ਨਾਂ ਸ਼ਵਨਾਸਾਦ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਪਹਿਲਾਂ ਮੂਵੀਆਂ ਬਲੈਕ ਐਂਡ ਵਾਈਟ ਹੁੰਦਿਆਂ ਸਨ ਪਰ ਹੁਣ ਟੈਕਨੋਲੋਜੀ ਕਾਰਨ ਫਿਲਮਾਂ ਅਸੀਂ ਰੰਗੀਨ ਦੇਖ ਸਕਦੇ ਹਾਂ ਅਸੀਂ ਆਪਣੇ ਮੋਬਾਇਲ 'ਤੇ ਲੈਪਟੋਪ 'ਤੇ ਆਰਾਮ ਨਾਲ ਬੈਠ ਕੇ ਕੋਈ ਵੀ ਮੂਵੀਜ ਆਰਾਮ ਨਾਲ ਦੇਖ ਸਕਦੇ ਹਾਂ ਮੇਰਾ ਐਕਸ਼ਨ ਹੀਰੋ ਅਕਸ਼ੇ ਕੁਮਾਰ ਹੈ ਉਹ ਮੈਨੂੰ ਬਹੁਤ ਪਸੰਦ ਹੈ ਉਸਦੀ ਮੂਵੀਜ਼ ਬਹੁਤ ਚੰਗੀ ਹੁੰਦੀ ਹੈ ਉਹ ਕਿਸੇ ਵੀ ਫਿਲਮ ਅਤੇ ਉਹਨੂੰ ਬਹੁਤ ਚੰਗੀ ਤਰ੍ਹਾਂ ਕਰਦਾ ਹੈ ਉਹ ਬਹੁਤ ਇੱਕ ਅੱਛਾ ਅਦਾਕਾਰ ਹੈ ਉਸਨੂੰ ਬਹੁਤ ਸਾਰੇ ਅਵਾਰਡ ਵੀ ਮਿਲੇ ਹਨ ਉਹ ਹਰ ਇੱਕ ਕਿਰਦਾਰ ਨੂੰ ਬਹੁਤ ਚੰਗੀ ਤਰ੍ਹਾਂ ਨਿਭਾਉਂਦਾ ਹੈ ਉਸਦੀ ਹਰ ਇੱਕ ਮੂਵੀ ਮੈਨੂੰ ਦੇਖਣਾ ਬਹੁਤ ਪਸੰਦ ਹੈ ਉਸਦੀ ਕੋਈ ਵੀ ਮੂਵੀ ਮੈਂ ਛੱਡਦੀ ਨਹੀਂ ਹਾਂ ਮੈਨੂੰ ਉਹ ਬਹੁਤ ਪਸੰਦ ਹੈ ਅਰੀਜੀਤ ਸਿੰਘ ਮੇਰਾ ਪਸੰਦੀਦਾ ਗਾਇਕ ਹੈ ਉਹ ਮੈਨੂੰ ਬਹੁਤ ਪਸੰਦ ਹੈ ਉਸਦੀ ਸਾਰੇ ਸੌਂਗ ਬਹੁਤ ਚੰਗੇ ਹੁੰਦੇ ਹਨ ਉਹ ਜ਼ਿਆਦਾ ਤੋਂ ਜ਼ਿਆਦਾ ਹਿੰਦੀ ਸੌਂਗ ਗਾਉਂਦਾ ਹੈ ਉਸ ਦੇ ਸਾਰੇ ਗਾਣੇ ਦਿਲ ਛੂਹ ਲੈਣ ਵਾਲੇ ਹੁੰਦੇ ਹਨ ਉਸਦੀ ਹਰ ਇੱਕ ਗਾਣਾ ਬਹੁਤ ਚੰਗਾ ਹੁੰਦਾ ਹੈ ਉਸਨੂੰ ਨੈਸ਼ਨਲ ਅਵਾਰਡ ਵੀ ਮਿਲੇ ਹਨ ਸੱਤ ਫਿਲਮਫੇਅਰ ਅਵਾਰਡ ਵੀ ਮਿਲੇ ਹਨ ਉਹ ਇੱਕ ਮਸ਼ਹੂਰ ਗਾਇਕ ਹੈ ਉਹ ਬਹੁਤ ਬਹੁਤ ਚੰਗਾ ਗਾਇਕ ਹੈ